ਕਸ਼ਮੀਰ ਯਾਤਰਾ ਦੇ ਦੌਰਾਨ ਮੇਰੇ ਨਾਲ ਵੀ ਬਹੁਤ ਇੱਕ ਅਣਕਿਆਸੀ ਏ ਇਹ ਚੀਜ਼ ਵਾਪਰੀ ਕਿ ਮੈਂ ਜਦੋਂ ਦੇਖਿਆ ਕਿ ਜਦੋਂ ਸੂਰਜ ਚੜ੍ਹ ਰਿਹਾ ਸੀਗਾ ਅਤੇ ਨਾਲ ਹੀ ਪਾਰ ਕਸ਼ਮੀਰ ਦੇ ਪਹਾੜਾਂ ਦੇ ਉੱਤੇ ਜਿਹੜੀ ਬਰਫ਼ ਪੈ ਰਹੀ ਸੀਗੀ ਉਹ ਇਸ ਤਰ੍ਹਾਂ ਦਾ ਦ੍ਰਿਸ਼ ਲੱਗ ਰਿਹਾ ਸੀਗਾ ਤਾਂ ਮੈਨੂੰ ਲੱਗਿਆ ਵੀ ਸ਼ਾਇਦ ਮੈਂ ਕੋਈ ਸੁਪਨਾ ਦੇਖ ਰਿਹਾ ਅਤੇ ਉਸੇ ਦੌਰਾਨ ਹੀ ਮੈਂ ਜਦੋਂ ਆਪਣਾ ਕੈਮਰਾ ਕੱਢਿਆ ਅਤੇ ਇਸ ਦ੍ਰਿਸ਼ ਨੂੰ ਜਿਹੜਾ ਆ ਉਹ ਕੈਪਚਰ ਕੀਤਾ ਅਤੇ ਹੁਣ ਵੀ ਜਦੋਂ ਮੈਂ ਉਸ ਦ੍ਰਿਸ਼ ਨੂੰ ਦੇਖਦਾ ਹਾਂ ਕਿਉਂਕਿ ਮੈਂ ਉਹਨੂੰ ਆਪਣੀ ਫੇਸਬੁੱਕ ਉੱਤੇ ਵੀ ਪੋਸਟ ਕੀਤਾ ਹੋਇਆ ਤਾਂ ਜਿੱਥੇ ਮੈਨੂੰ ਵੀ ਬਹੁਤ ਚੰਗਾ ਲੱਗਦਾ ਅਤੇ ਦੇਖਣ ਵਾਲੇ ਲੋਕਾਂ ਹੋਰਨਾਂ ਨੂੰ ਵੀ ਬਹੁਤ ਚੰਗਾ ਲੱਗਦਾ ਅਤੇ ਮੈਂ ਆਪਣੇ ਆਪ ਨੂੰ ਬਹੁਤ ਭਾਗਸ਼ਾਲੀ ਸਮਝਦਾ ਪੀ ਜਿੱਥੇ ਮੈਂ ਉਹ ਨਜ਼ਾਰਾ ਆਪਣੀਆਂ ਅੱਖਾਂ ਨਾਲ ਦੇਖਿਆ ਅਤੇ ਦੂਸਰਾ ਮੈਂ ਉਸਨੂੰ ਆਪਣੇ ਕੈਮਰੇ ਦੇ ਵਿੱਚ ਵੀ ਜਿਹੜਾ ਉਹ ਕੈਦ ਕਰ ਸਕਿਆ ਇਹ ਮੇਰੇ ਲਈ ਯਾਦਗਾਰੀ ਪਲ ਹੈ ਔਰ ਮੈਨੂੰ ਲੱਗਦਾ ਹੈ ਪੀ ਸ਼ਾਇਦ ਮੇਰੇ ਲਈ ਇਹ ਗੋਡ ਗਿਫਟ ਹੈ ਔਰ ਪਰਮਾਤਮਾ ਨੇ ਇਹ ਦ੍ਰਿਸ਼ ਮੈਂ ਹੀ ਦੇਖਿਆ ਔਰ ਦੂਸਰਾ ਜਿਹੜਾ ਮੈਂ ਬਾਕੀ ਲੋਕਾਂ ਨੂੰ ਦਿਖਾਉਣ ਵਾਸਤੇ ਇਸਨੂੰ ਟਰੈਕ ਕਰ ਸਕਿਆ ਕਿਉਂਕਿ ਇਹ ਮੇਰੀ ਹੋਬੀ ਹੈ ਕਿ ਔਰ ਮੇਰਾ ਕੰਮ ਵੀ ਹੈ ਕਿ ਮੈਂ ਜ ਜਿੱਥੇ ਵੀ ਜਾਂਦਾ ਤਸਵੀਰਾਂ ਕੈਦ ਕਰਦਾ ਪਰ ਇਹ ਜਿਹੜਾ ਦ੍ਰਿਸ਼ ਹੈ ਇਹ ਅਣਕਿਸ ਕਿਆਸੀ ਜਿਹੜੀ ਘਟਨਾ ਮੇਰੀ ਯਾਤਰਾ ਦੇ ਦੌਰਾਨ ਵਾਪਰੀ ਅਤੇ ਮੈਂ ਇਸ ਨੂੰ ਕੈਮਰੇ ਵਿੱਚ ਵੀ ਕਲਿੱਕ ਕਰ ਪਾਇਆ ਅਤੇ ਇਹ ਮੇਰੇ ਲਈ ਇੱਕ ਯਾਦਗਾਰੀ ਪਲ ਬਣ ਗਿਆ ਹੈ